ਵੈਸੇ ਤਾਂ ਸਾਡੇ ਪਿੰਡ 'ਚ ਦਸਤ ਦੇ ਇਲਾਜ ਲਈ ਕਾਫੀ ਘਰੇਲੂ ਨੁਸਖੇ ਅਪਣਾਏ ਜਾਂਦੇ ਹੈ ਪਰ ਮੈਨੂੰ ਇਹ ਮੇਰੇ ਦਾਦਾ ਜੀ ਤੋਂ ਪਤਾ ਲੱਗਿਆ ਸੀ ਕਿ ਇਸਵਗੋਲ ਨੂੰ ਪਾਣੀ ਦੇ ਵਿੱਚ ਘੋਲ ਕੇ ਪੀਣ ਨਾਲ ਦਸਤ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਮੇਰੇ ਮੰਮਾ ਨੇ ਦੱਸਿਆ ਸੀਗਾ ਵੀ ਚਾਹ ਦੇ ਵਿੱਚ ਬਰਫ਼ ਪੀ ਲਉ ਘੋਲ ਕੇ ਤਾਂ ਉਹਦੇ ਨਾਲ ਵੀ ਦਸਤ ਕੰਟਰੋਲ ਹੋ ਜਾਂਦੇ ਨੇ ਕਾਫੀ ਹੱਦ ਤੱਕ ਸਾਡੇ ਪਿੰਡ 'ਚ ਵੀ ਕਾਫੀ ਜੇ ਕਿਸੇ ਬੱਚਿਆਂ ਨੂੰ ਦਸਤ ਵਗੈਰਾ ਦੀ ਪ੍ਰੋਬਲਮ ਹੋਵੇ ਤਾਂ ਉਹ ਚਾਹ ਦੇ ਵਿੱਚ ਬਰਫ਼ ਘੋਲ ਕੇ ਪੀ ਲੈਂਦੇ ਹੈ ਤਾਂ ਉਹਦੇ ਨਾਲ ਦਸਤ ਦਾ ਇਲਾਜ ਹੋ ਜਾਂਦਾ